ਮੈਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਸਾਰੀਆਂ ਐਕਟੀਵਿਟੀਜ਼ ਕਰਦੀ ਹਾ ਉਹਨਾਂ ਵਿੱਚੋਂ ਮੋਰਨਿੰਗ ਵੋਕ ਅਤੇ ਈਵਨਿੰਗ ਵੋਕ ਦੋਨੋਂ ਮੇਨ ਮੇਨ ਨੇ ਜੋ ਕਿ ਮੇਰੇ ਹਰ ਦਿਨ ਸ਼ਡਿਊਲ ਦੇ ਵਿੱਚ ਹੁੰਦੇ ਹੀ ਨੇ ਅਤੇ ਮੈਂ ਮੋਰਨਿੰਗ ਵੇ ਵੋਕ ਜਿਹੜੀ ਹੈ ਸਵੇਰੇ ਛੇ ਵਜੇ ਕਰਦੀ ਹਾਂ ਅਤੇ ਮੈਂ ਹਮੇਸ਼ਾ ਹੀ ਗਰਾਊਂਡ ਦੇ ਵਿੱਚ ਘੁੰਮਣ ਜਾਂਦੀ ਹਾਂ ਅਤੇ ਆਪਣੇ ਮੇਰੇ ਨਾਲ ਜਿਹੜੇ ਮੇਰੇ ਇੱਕ ਫਰੈਂਡ ਨੇ ਉਹ ਵੀ ਮੈਨੂੰ ਜੁਆਇਨ ਕਰਦੇ ਨੇ ਅਤੇ ਅਸੀਂ ਦੋਨੋਂ ਗੱਲਾਂ ਕਰਦੇ ਕਰਦੇ ਅਤੇ ਤਾਜ਼ਗੀ ਨੂੰ ਮਹਿਸੂਸ ਕਰਦੇ ਕਰਦੇ ਅਸੀਂ ਵੋਕ ਕਰਦੇ ਹਾਂ ਅਤੇ ਅਸੀਂ ਹਮੇਸ਼ਾ ਹੀ ਨੰਗੇ ਪੈਰ ਘਾਹ ਦੇ ਉੱਤੇ ਚੱਲਣਾ ਚੱਲਦੇ ਹਾਂ ਤਾਂ ਜੋ ਇਹ ਇਹ ਸਾਡੇ ਸਰੀਰ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਆ ਅਤੇ ਫਿਰ ਅਸੀਂ ਵੋਕ ਤੋਂ ਜਦੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਅਸੀਂ ਦੋਨੋਂ ਚਾਹ ਇਕੱਠੇ ਬੈਠ ਕੇ ਪੀਂਦੇ ਹਾਂ ਅਤੇ ਉਸ ਉਸ ਤੋਂ ਬਾਅਦ ਜਦੋਂ ਵੀ ਮੈਂ ਸ਼ਾਮ ਨੂੰ ਆਪਣੇ ਫਰੈਂਡਸ ਦੇ ਨਾਲ ਜਾਂਦੀ ਹਾਂ ਅਤੇ ਉਨ ਉਹਨਾਂ ਨਾਲ ਟਾਈਮ ਸਪੈਂਡ ਕਰਦੀ ਹਾਂ ਉਹਨਾਂ ਨਾਲ ਮੈਂ ਗੇਮਜ਼ ਖੇਡਦੀ ਹਾਂ ਟੈਨਿਸ ਖੇਡਦੀ ਹਾਂ ਆਪਣੀ ਫਰੈਂਡਸ ਦੇ ਨਾਲ ਅਤੇ ਉਸ ਤੋਂ ਬਾਅਦ ਅਸੀਂ ਫੇ ਮੋਰਨਿ ਕਈ ਵਾਰ ਅਸੀਂ ਗੇਮਜ਼ ਖੇਡਦੇ ਹਾਂ ਜਾਂ ਕਈ ਵਾਰ ਸ਼ਾਮ ਨੂੰ ਅਸੀਂ ਵੋਕ 'ਤੇ ਮੈਂ ਆਪਣੇ ਫਰੈਂਡਸ ਦੇ ਨਾਲ ਜਾਂਦੀ ਹਾਂ ਅਤੇ ਅਸੀਂ ਗੱਲਾਂ ਕਰਦੇ ਕਰਦੇ ਆਪਣਾ ਪੂਰਾ ਜਿਹੜਾ ਸਾਡਾ ਦਿਨ ਗੁਜ਼ਰਿਆ ਕਿੱਦਾਂ ਗੁਜ਼ਰਿਆ ਉਸ ਚੀਜ਼ ਨੂੰ ਵੀ ਡਿਸਕਸ ਕਰਦੇ ਹਾਂ ਅਤੇ ਇੰਜੋਏ ਕਰਦੇ ਹਾਂ